ਭਾਰਤ ਦੀ ਜਿਹੜੀ ਆਵਾਜਾਈ ਪ੍ਰਣਾਲੀ ਹੈਗੀ ਹੈ ਵੇਸੇ ਤਾਂ ਹੈ ਬਹੁਤ ਵਧੀਆ ਹੈਗੀ ਆ ਪਰ ਕਈ ਥਾਵਾਂ 'ਤੇ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਜਿਵੇਂ ਆਪਾਂ ਯ ਯਾਤਰਾ ਦੌਰਾਨ ਆਪਾਂ ਘੁੰਮਣ ਜਾਂਦੇ ਹੈਗੇ ਹਾਂ ਅਤੇ ਜੇ ਆਪਾਂ ਉੱਦਾਂ ਹੀ ਚਲ ਜੀਏ ਮੀਨਜ਼ ਬਿਨਾਂ ਬੁਕਿੰਗ ਕਰਵਾਏ ਟਰੇਨ ਦੇ ਵਿੱਚ ਉੱਦਾਂ ਹੀ ਚਲ ਜੀਏ ਜਨਰਲ ਡੱਬੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਭੀੜ ਹੁੰਦੀ ਆ ਅਤੇ ਭੀੜ ਭੜੱਕੇ ਕਰਕੇ ਉੱਥੇ ਜਿਹੜਾ ਸਫ਼ਰ ਕਰਨਾ ਹੈਗਾ ਵਾ ਉਹ ਬਹੁਤ ਜ਼ਿਆਦਾ ਕੀ ਹੈ ਔਖਾ ਹੋ ਜਾਂਦਾ ਹੈਗਾ ਵਾ ਅਤੇ ਜੇ ਬੁਕਿੰਗ ਕਰਵਾਈ ਹੋਵੇ ਤਾਂ ਕਈ ਵਾਰ ਸੀਟ 'ਤੇ ਆ ਕੇ ਕੋਈ ਵੀ ਆਣ ਕੇ ਬੈਠ ਜਾਂਦਾ ਹੈਗਾ ਵਾ ਅਤੇ ਇਹੀ ਹੈਗੀ ਸਲਾਹ ਕਿ ਜਿਹੜਾ ਗੋਮੈਂਟ ਇੱਕ ਸਰਕਾਰ ਹੈਗੀ ਆ ਕਿ ਉਹਨੂੰ ਚਾਹੀਦਾ ਵਾ ਕਿ ਜਿਹੜੀਆਂ ਟ੍ਰੇਨਜ਼ ਹੈਗੀਆਂ ਵਾ ਕਿ ਉਹਨਾਂ ਦੀ ਜਿਹੜੀ ਹੈਗੀ ਆ ਕਿ ਟ੍ਰੇਨ ਜਿਹੜੀਆਂ ਹੈਗੀਆਂ ਵਾ ਕਈ ਵਾਰ ਟਾਈਮ ਸਿਰ ਨਹੀਂ ਪਹੁੰਚਦੀਆਂ ਹੈਗੀਆਂ ਕਈ ਦੋ ਘੰਟੇ ਤੋਂ ਲੇਟ ਹੋ ਜਾਂਦੀਆਂ ਵਾਂ ਅਤੇ ਇਸ ਕਰਕੇ ਹੀ ਆ ਕਿ ਟ੍ਰੇਨ ਵੀ ਆਪਣੇ ਸਮੇਂ ਸਿਰ ਆਵੇ ਕਿ ਯਾਤਰਾ ਦੋਰਾਨ ਕਈ ਵਾਰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈਗੀ ਕਿਉਂਕਿ ਜੇ ਆਪਾਂ ਕਿਤੇ ਜਾਣਾ ਹੋਈਏ ਅਤੇ ਆਪਣੀ ਜਿਹੜੀ ਟ੍ਰੇਨ ਪਹਿਲਾਂ ਹੀ ਦੋ ਘੰਟੇ ਲੇਟ ਹੋ ਗਈ ਅਤੇ ਅੱਗੋਂ ਆਪਾਂ ਹੋਰ ਟ੍ਰੇਨ ਆਪਣੀ ਫੜਨੀ ਹੋਵੇ ਅਤੇ ਜੇ ਇਹ ਦੋ ਘੰਟੇ ਲੇਟ ਹੈਗੀ ਅਤੇ ਨੈਕਸਟ ਟ੍ਰੇਨ ਕਿ ਆਪਣੀ ਛੁੱਟ ਜਾਂਦੀ ਹੈਗੀ ਆ ਅਤੇ ਜਿਹੜੀ ਟ੍ਰੇਨ ਹੋੋਣ ਉਹ ਵੀ ਸਮੇਂ ਦੀਆਂ ਪਾਬੰਦ ਹੋਣ ਕਿ ਜੇ ਜਿੰਨੇ ਟਾਈਮ 'ਤੇ ਉਹਨੇ ਜਿਸ ਪਲੈਟਫੋਮ 'ਤੇ ਆਉਣਾ ਗਾ ਉਸ ਪਲੈਟਫੋਮ 'ਤੇ ਹੀ ਉਹ ਆਵੇ ਮੀਨਜ਼ ਉਹ ਲੇਟ ਨਾ ਹੋਵੇ ਕਿਉਂਕਿ ਜ਼ਿਆਦਾਤਰ ਭਾਰਤ ਵਿੱਚ ਕੀ ਆ ਕਿ ਜਿਹੜੀਆਂ ਟ੍ਰੇਨਜ਼ ਹੈਗੀਆਂ ਵਾ ਉਹ ਸਮੇਂ ਦੀਆਂ ਪਾਬੰਦ ਨਹੀਂ ਹੈਗੀਆਂ ਉਹ ਹਮੇਸ਼ਾਂ ਕੀ ਹੈ ਲੇਟ ਪਹੁੰਚਦੀਆਂ ਹੈਗੀਆਂ ਵਾਂ ਭਾਵੇਂ ਉਹ ਅੱਧਾ ਘੰਟਾ ਲੇਟ ਹੋਵੇ ਭਾਵੇਂ ਉਹ ਦੋ ਘੰਟੇ ਲੇਟ ਹੋਵੇ ਅਤੇ ਕਈ ਵਾਰੀ ਇਹ ਹੁੰਦਾ ਵਾ ਕਿ ਵਿੱਚ ਹੀ ਰਸਤੇ ਵਿੱਚ ਲੋਕ ਜਿਹੜੇ ਹੈਗੇ ਹੈ ਰੈਲੀ ਦੇਣੀ ਸ਼ੁਰੂ ਕਰ ਦਿੰਦੇ ਹੈਗੇ ਆ ਇਸ ਕਰਕੇ ਉਹ ਸਾਰਾ ਸਿਸਟਮ ਜਿਹੜੀਆਂ ਰੈਲੀਆਂ ਵਗੈਰਾ ਹੈਗੀਆਂ ਵਾਂ ਧਰਨੇ ਦਿੰਦੇ ਹੈਗੇ ਇਹ ਸਭ ਕੁਛ ਕੀ ਹੈ ਬੰਦ ਹੋਣਾ ਚਾਹੀਦਾ ਹੈਗਾ ਵਾ